ਸਤਿ ਸ਼੍ਰੀ ਅਕਾਲ ਮੈਂ ਪੰਜਾਬ ਵਿੱਚ ਅੰਮ੍ਰਿਤਸਰ ਵਿੱਚ ਰਹਿੰਦੀ ਹਾਂ ਇੱਥੇ ਇੱਕ ਖੇਤਰ ਨਹੀਂ ਬਹੁਤ ਸਾਰੇ ਖੇਤਰ ਹੈ ਜਿੱਥੇ ਮੈਂ ਜਾ ਕੇ ਸੱਭਿਆਚਾਰ ਜਾਂ ਧਾਰਮਿਕ ਮਹੱਤਵ ਨੂੰ ਸਮਝ ਸਕਦੀ ਹਾਂ ਜਿੱਦਾਂ ਕੀ ਦੁਰਗਿਆਣਾ ਟੈਂਪਲ ਹੋ ਗਿਆ ਜਾਂ ਗੋਲਡਨ ਟੈਂਪਲ ਹੋ ਗਿਆ ਗੋਲਡਨ ਟੈਂਪਲ ਵਿੱਚ ਕਿੰਨੇ ਸਿੱਖ ਅਤੇ ਕਿੰਨੇ ਹਿੰਦੂ ਅਤੇ ਕਿੰਨੇ ਬਾਹਰ ਦੇ ਅੰਗਰੇਜ਼ ਲੋਕ ਆਉਂਦੇ ਆ ਅਤੇ ਉੱਥੇ ਸੱਭਿਆਚਾਰ ਦੇਖਦੇ ਆ ਕਿ ਕਿੱਦਾਂ ਲੋਕ ਇੱਥੇ ਲੰਗਰ ਦੀ ਸੇਵਾ ਕਰ ਰਹੇ ਆ ਆ ਕੇ ਮੱਥਾ ਟੇਕ ਰਿਹਾ ਦੁਰਗਿਆਣਾ ਟੈਂਪਲ ਜਾ ਕੇ ਦੇਖਦੇ ਆ ਕਿ ਉਹ ਕਿੱਦਾਂ ਲੋਕ ਉੱਥੇ ਰਾਮ ਭਗਵਾਨ ਅਤੇ ਸ਼ਿਵ ਭਗਵਾਨ ਦੀ ਉਹਦੇ ਵਿੱਚ ਲੀਨ ਹੈਗੇ ਆ ਇੱਥੇ ਇੱਕ ਨਹੀਂ ਬਹੁਤ ਸਾਰੀ ਜਗ੍ਹਾ ਮੇਰੇ ਸ਼ਹਿਰ ਵਿੱਚ ਦੂਜਾ ਉੱਥੇ ਜਾ ਕੇ ਸੱਭਿਆਚਾਰ ਬਹੁਤ ਅਲੱਗ ਹੈ ਲੋਕਾਂ ਦਾ ਕਈ ਸਾਰੇ ਰਸਮਾਂ ਆਉਂਦੀਆ ਜਿੱਦਾਂ ਕੀ ਗੋਲਡਨ ਟੈਂਪਲ ਵਿੱਚ ਜਾਣ ਲਈ ਸਾਨੂੰ ਸਭ ਤੋਂ ਪਹਿਲਾਂ ਆਪਣੇ ਜੁੱਤੇ ਜੁਰਾਬੇ ਸਭ ਕੁਝ ਉਤਾਰਨਾ ਹੁੰਦਾ ਹੈ ਥੱਲੋਂ ਪੈਰ ਨੂੰ ਸਾਫ ਕਰਕੇ ਧੋ ਕਰਕੇ ਇਕਦਮ ਸਵੱਛ ਹੋ ਕੇ ਅੰਦਰ ਜਾਣਾ ਹੁੰਦਾ ਸਿਰ 'ਤੇ ਆਪਣਾ ਕੱਪੜਾ ਢੱਕਿਆ ਹੋਣਾ ਚਾਹੀਦਾ ਹੈ ਅਤੇ ਗੋ ਦੁਰਗਿਆਣਾ ਟੈਂਪਲ ਵਿੱਚ ਵੀ ਕਈ ਲੋਕੀ ਸਿਰ ਢੱਕ ਕੇ ਅੰਦਰ ਜਾਂਦੇ ਹੁੰਦੇ ਅਤੇ ਭਗਵਾਤ ਦੀ ਭਗਤੀ ਕਰਦੇ ਹੁੰਦੇ ਆ ਧਾਰਮਿਕ ਮਹੱਤਵਤਾ ਇਹ ਹੀ ਹੋ ਹੁੰਦਾ ਕਿ ਦੋਨਾਂ 'ਚ ਬਸ ਮਨ ਜੋ ਹੋਵੇ ਸੱਚਾ ਹੋਵੇ ਧੰਨਵਾਦ ਜੀ